ਮੇਰੇ ਮਨਪਸੰਦ ਗਾਇਕ ਗੁਰਦਾਸ ਮਾਨ ਸਤਿੰਦਰ ਸਰਤਾਜ ਹੈ ਜਿਹਨਾਂ ਦੇ ਗਾਏ ਹੋਏ ਲੋਕ ਗੀਤ ਮੇਰੇ ਮਨ ਨੂੰ ਕਾਫੀ ਸਕੂਨ ਦਿੰਦੇ ਨੇ ਅਤੇ ਖਾਲੀ ਟਾਈਮ ਵਿੱਚ ਮੈਂ ਵੀ ਉਹਨਾਂ ਦੇ ਗੀਤਾਂ ਨੂੰ ਗੁਣਗੁਣਾਉਂਦਾ ਰਹਿੰਦਾ ਹਾਂ ਜਿਸ ਦੇ ਨਾਲ ਮੇਰੇ ਮਨ ਨੂੰ ਕਾਫੀ ਸ਼ਾਂਤੀ ਮਿਲਦੀ ਹੈ ਅਤੇ ਮੈਨੂੰ ਗਾਉਣ ਦਾ ਰੁਝਾਨ ਵੀ ਮਿਲ ਜਾਂਦਾ ਹੈ ਜਿਸ ਨਾਲ ਖੁਸ਼ੀ ਔਰ ਖੁਸ਼ੀ ਮਿਲਦੀ ਹੈ ਅਤੇ ਅੱਗੇ ਤੋਂ ਗਾਉਣ ਲਈ ਹੋਰ ਪ੍ਰੇਰਨਾ ਮਿਲਦੀ ਹੈ ਇਸ ਤਰ੍ਹਾਂ ਮੈਂ ਗਾਉਂਦਾ ਹੋਇਆ ਆਪਣੇ ਫਰੈਂਡ ਸਰਕਲ ਅਤੇ ਕੋਲਜ ਲਾਈਫ ਵਿੱਚ ਕੁਝ ਜਗ੍ਹਾ ਪਾਰਟੀਸਪੇਟ ਵੀ ਕੀਤਾ ਜਿਸ ਨਾਲ ਮੈਨੂੰ ਆਪਣਾ ਪੱਖ ਰੱਖਣ ਅਤੇ ਅਪ ਦੂਸਰੇ ਗਾਇਕੀ ਦੀਆਂ ਡੁੰਘਾਈਆਂ ਨੂੰ ਜਾਣਨ ਦਾ ਮੌਕਾ ਮਿਲਿਆ ਜਿਸ ਨਾਲ ਅੱਗੇ ਗਾਇਕੀ ਨੂੰ ਹੋਰ ਨਿਖਾਰਨ ਲਈ ਲਗਾਤਾਰ ਦ੍ਰਿੜੇ ਇਰਾਦੇ ਨਾਲ ਚੱਲ ਰਿਹਾ ਹਾਂ ਜੋ ਅੱਜ ਇੱਕ ਤਰ੍ਹਾਂ ਨਾਲ ਲੋਕਾਂ ਦੇ ਖੁਸ਼ੀ ਦਾ ਜ਼ਰੀਆ ਵੀ ਬਣ ਰਿਹਾ ਹੈ